ਮੈਂ ਜ਼ਿਆਦਾਤਰ ਆਪਣੇ ਯਾਰਾਂ ਦੋਸਤਾਂ ਨਾਲ਼ ਹੀ ਪ੍ਰੈਫ਼ਰ ਕਰਦਾ ਵੀ ਰੌਕ ਕਲਾਈਮਬਿੰਗ ਕਰਨ ਜਾਇਆ ਜਾਵੇ ਠੀਕ ਹੈ ਜੀ ਅਤੇ ਬਾਕੀ ਨਾਲ ਦੇ ਇਹੋ ਜਿਹੇ ਹੈ ਪੁੱਠੀਆਂ ਸਿੱਧੀਆਂ ਹਰਕਤਾਂ ਉਹ ਕਰਦੇ ਰਹਿੰਦੇ ਹੈ ਇੱਕ ਵਾਰ ਇੱਦਾਂ ਹੀ ਕੋਈ ਇਹੋ ਜਿਹਾ ਹੋ ਗਿਆ ਕਿ ਰੱਸੀ ਉਹ ਟੁੱਟ ਗਈ ਸੀ ਬੰਦਾ ਸੀ ਕੋਈ ਨਾਲ਼ ਦਾ ਸਾਥੀ ਉਹ ਉਹ ਉੱਤੇ ਚੜ੍ਹ ਰਿਹਾ ਤਾ ਅਤੇ ਬਸ ਪਤਾ ਨਹੀਂ ਉੱਦਾਂ ਕੀ ਹੋਇਆ ਕੀ ਨਹੀਂ ਕਿ ਉਹਦੀ ਰੱਸੀ ਟੁੱਟ ਗਈ ਬਸ ਇਕੱਲੀ ਹੁੱਕ ਹੁੱਕ ਹੀ ਲੱਗੀ ਰਹਿ ਗਈ ਉਹ ਬਸ ਬੰਦਾ ਗੱਭੇ ਜਿਹੇ ਪੁੱਜਿਆ ਵਾ ਤਾ ਅਤੇ ਆਲਾ ਦੁਆਲਾ ਦੇਖੇ ਕਿਉਂਕਿ ਉੱਦਾਂ ਤਾਂ ਚਲੋ ਚੜ੍ਹਨਾ ਉੱਤਰਨਾ ਆਉਂਦਾ ਬੰਦੇ ਨੂੰ ਪਰ ਫੇਰ ਵੀ ਕਿਤੇ ਨਾ ਕਿਤੇ ਉਹਦੀ ਸੇਫ਼ਟੀ ਰਹਿੰਦੀ ਹੈ ਅਤੇ ਕੁਝ ਬੰਦੇ ਨੂੰ ਥੋੜ੍ਹਾ ਜਿਹਾ ਸਹਿਯੋਗ ਜਿਹਾ ਰਹਿੰਦਾ ਬੰਦਾ ਘਬਰਾਉਂਦਾ ਨਹੀਂ ਸੋ ਇੱਦਾਂ ਕਰਕੇ ਉਹ ਸਮੇਂ ਫੇਰ ਬੜੀ ਤਸ਼ੱਦਦ ਕੀਤੀ ਅਤੇ ਉਹ ਬੰਦੇ ਨੂੰ ਫੇਰ ਸਹੀ ਸਲਾਮਤ ਉਤਾਰਿਆ ਜਾਣੀ ਕਿ